ਭੰਗੜਾ ਐਰੋਬਿਕਸ ਕਰਨ ਲਈ ਕਈ ਤਰ੍ਹਾਂ ਦੇ ਗੀਤ ਪ੍ਰਚਲਿਤ ਹਨ ਜਿਵੇਂ ਕਿ ਜੇ ਤੂੰ ਨੱਚੀ ਨਾ ਗੋਰੀਏ ਮੇਰੇ ਨਾਲ ਲਹਿੰਗੇ 'ਤੇ ਸ਼ਰਾਬ ਡੋਲਦੂੰ ਜੇ ਤੂੰ ਨੱਚੀ ਨਾ ਮੇਰੇ ਨਾਲ ਗੋਰੀਏ ਨੀ ਲਹਿੰਗੇ 'ਤੇ ਸ਼ਰਾਬ ਡੋਲਦੂੰ ਦੂਜਾ ਦੇ ਦੇ ਗੇੜਾ ਨੀ ਦੇ ਦੇ ਗੇੜਾ ਦੇ ਦੇ ਗੇੜਾ ਸ਼ੌਕ ਦਾ ਨਨਾਣੇ ਗੋਰੀਏ ਦੇ ਦੇ ਗੇੜਾ ਦੇ ਦੇ ਗੇੜਾ ਮੇਰੀ ਕਾਲੀ ਐਕਟੀਵਾ ਦਾ ਮੇਰੀ ਕਾਲੀ ਐਕਟੀਵਾ ਦਾ ਖੜ੍ਹ ਗਿਆ ਹੈਡਲ ਫੜ ਕੇ ਨੀ ਤੂੰ ਮੇਰੀ ਕਾਲੀ ਐਕਟੀਵਾ ਦਾ ਹੈਂਡਲ ਫੜ ਗਿਆ ਖੜ੍ਹ ਕੇ ਨੀ ਤੂੰ ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ ਸਭਨਾਂ ਨੂੰ ਇੱਕ ਮੌਕਾ ਦਿਆਂਗੇ ਚਿੱਟੇ ਸੂਟ 'ਤੇ ਦਾਗ ਪੈ ਗਏ ਗਲੀ ਤੇਰੀ ਵਿੱਚ ਯਾਰਾ ਨੀ ਗਲੀਆਂ 'ਚ ਮੈਂ ਭਿੱਜ ਗਈ ਤੈਨੂੰ ਮਿਲਣੇ ਨੂੰ ਮੁਟਿਆਰ ਨੀ ਕੋਈ ਕੀਲ ਸਪੇਰਾ ਲੈ ਜੂਗਾ ਨਾਗ ਸਾਂਭ ਲੈ ਜੁਲਫਾਂ ਦੇ ਤੇਰੀ ਨਾਗਿਨ ਟਿੰਗ ਟਿੰਗ ਟਿੰਗ ਟਿੰਗ ਨੀ ਤੂੰ ਕੀਲ